ਪਟਿਆਲਾ ਸ਼ਹਿਰ ਦੇ ਵਿੱਚ ਲੋਕ ਬਹੁਤ ਜ਼ਿਆਦਾ ਕੂੜੇ ਕਚਰੇ ਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਉਹਨਾਂ ਦੀ ਸਿਹਤ ਉੱਤੇ ਬਹੁਤ ਪ੍ਰਭਾਵ ਪਾ ਰਹੇ ਹਨ ਜਿਵੇਂ ਕਿ ਲੋਕ ਕੂੜੇ ਕਚਰੇ ਨੂੰ ਆਪਣੇ ਸੜਕਾਂ ਦੇ ਉੱਤੇ ਹੀ ਖਿਲਾਰ ਦਿੰਦੇ ਹਨ ਜਿਸ ਕਰਕੇ ਉੱਥੇ ਜਾਨਵਰ ਖਾਂਦੇ ਹਨ ਅਤੇ ਮੱਛਰ ਪੈਦਾ ਹੁੰਦੇ ਹਨ ਜਿਹਨਾਂ ਕਰਕੇ ਬਿਮਾਰੀਆਂ ਪੈਦਾ ਹੁੰਦੀਆ ਹਨ ਇਸ ਨੂੰ ਠੀਕ ਕਰਨ ਦੇ ਲਈ ਅਸੀਂ ਲੀਡਰਾਂ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਉਹ ਵੱਖ ਵੱਖ ਵਿਅਕਤੀਆਂ ਨੂੰ ਲਗਾਉਣ ਜੋ ਕਿ ਇਸ ਕੂੜੇ ਕਚਰੇ ਨੂੰ ਇਕੱਠਾ ਕਰਨ ਅਤੇ ਇੱਕ ਅਸਥਾਨ 'ਤੇ ਇਸ ਨੂੰ ਰੀਸਾਈਕਲ ਕਰਨ ਧੰਨਵਾਦ